ਬਰਨਾਲੇ ਜ਼ਿਲ੍ਹੇ ਵਿੱਚ ਔਰਤਾਂ ਨੂੰ ਰੁਜਗਾ ਰੁਜ਼ਗਾਰ ਅਤੇ ਸਿੱਖਿਆ ਵਿੱਚ ਕਈ ਤਰ੍ਹਾਂ ਦੀ ਚੁਣੌਤੀਆਂ ਆ ਰਹੀਆਂ ਹਨ ਸਭ ਤੋਂ ਪਹਿਲਾਂ ਦੂਰ ਦਰਾਡੇ ਤੋਂ ਆਉਣਾ ਜਾਣਾ ਅਤੇ ਪ੍ਰਾਈਵੇਟ ਕਾਲਜਾਂ ਦੀਆਂ ਵੱਧ ਰਹੀਆਂ ਫੀਸਾਂ ਰੁਜ਼ਗਾਰ ਦੇ ਮੌਕੇ ਵਿੱਚ ਚੁਣੌਤੀਆਂ ਕੰਪੀਟੀਸ਼ਨ ਵੱਧ ਹੋਣਾ ਪ੍ਰਵਾਸੀਆਂ ਦਾ ਆਉਣਾ ਫੁੱਲ ਟਾਈਮ ਜੋਬ ਅਤੇ ਜੈਂਟਸ ਸਟਾਫ ਨਾਲ ਇਕੱਲੇ ਕੰਮ ਕਰਨ ਵਿੱਚ ਵੀ ਦਿੱਕਤ ਮਹਿਸੂਸ ਕਰਦੀਆਂ ਹਨ ਸਮਾਜਿਕ ਸਥਿਤੀ ਔਰਤਾਂ ਦੀ ਸਮਾਜ ਸਥਿਤੀ ਬਰਨਾਲੇ ਜ਼ਿਲ੍ਹੇ ਵਿੱਚ ਠੀਕ ਹੈ ਸਿਰਫ ਜ਼ਿਆਦਾ ਗਰੀਬੀ ਵਾਲੀਆਂ ਔਰਤਾਂ ਦਾ ਹੀ ਜੀਵਨ ਪੱਧਰ ਨੀਵਾਂ ਹੈ ਉਹਨਾਂ ਨੂੰ ਘਰਾਂ ਦੀ ਸਫਾਈ ਪਸ਼ੂ ਸੰਭਾਲਣ ਆਦਿ ਲਈ ਕੰਮ ਘਰਾਂ ਵਿੱਚ ਕੰਮ ਕਰਨੇ ਪੈਂਦੇ ਹਨ ਬਰਨਾਲੇ ਜ਼ਿਲ੍ਹੇ ਵਿੱਚ ਮੌਕੇ ਬਰਨਾਲੇ ਜ਼ਿਲ੍ਹੇ ਵਿੱਚ ਰੁਜ਼ਗਾਰ ਦੇ ਮੌਕੇ ਵੀ ਕਈ ਤਰ੍ਹਾਂ ਦੇ ਪੈ ਨਵੇਂ ਪੈਦਾ ਹੋਏ ਹਨ ਜਿਵੇਂ ਕਿ ਆਊਟਲੈਟ ਇਸ ਵਿੱਚ ਔਰਤਾਂ ਕਿਸੇ ਵੀ ਦੁਕਾਨ 'ਤੇ ਮੈਨੇਜਰ ਦਾ ਕੰਮ ਕਰ ਸਕਦੀਆਂ ਹਨ ਅਤੇ ਆਊਟਲੈਟ ਵਿੱਚ ਸਫਾਈ ਦੇ ਵੀ ਕਈ ਤਰ੍ਹਾਂ ਦੇ ਕੰਮਾਂ 'ਤੇ ਔਰਤਾਂ ਲੱਗੀਆਂ ਹੋਈਆਂ ਹਨ ਅਤੇ ਆਮ ਤੌਰ 'ਤੇ ਦੇਖਿਆ ਰੁਜ਼ਗਾਰ ਦੇ ਮੌਕਿਆਂ ਦੇ ਵਿੱਚ ਟਰਾਈਡੈਂਟ ਕੰਪਨੀ ਇਸ ਵਿੱਚ ਵੀ ਔਰਤਾਂ ਆਪਣਾ ਰੁਜ਼ਗਾਰ ਸੰਬੰਧੀ ਜਾ ਕੇ ਆਪਣੀ ਡਿਊਟੀ ਕਰ ਸਕਦੀਆਂ ਹਨ ਸਮਾਜਿਕ ਸਥਿਤੀ ਬਰਨਾਲੇ ਜ਼ਿਲ੍ਹੇ ਦੀ ਸਮਾਜਿਕ ਸਥਿਤੀ ਬਹੁਤ ਵਧੀਆ ਹੈ ਜ਼ਿਆਦਾ ਤੌਰ 'ਤੇ ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਬਰਨਾਲਾ ਜ਼ਿਲ੍ਹਾ ਕੋਈ ਜ਼ਿਆਦਾ ਗਰੀਬ ਜ਼ਿਲ੍ਹਿਆਂ ਵਿੱਚੋਂ ਨਹੀਂ ਗਿਣਿਆ ਗਿਆ ਹੈ ਇੱਥੇ ਜ਼ਿਲ੍ਹੇ ਦੇ ਵਿੱਚ ਹਰ ਇੱਕ ਲੋਕਾਂ ਕੋਲ ਆਪਣੀ ਜ਼ਮੀਨਾਂ ਵੀ ਕਾਫੀ ਹਨ ਜੇਕਰ ਔਰਤਾਂ ਦੀ ਜੇ ਕਿਸੇ ਔਰਤ ਦੀ ਸਥਿਤੀ ਮਾੜੀ ਉਹ ਸਿਰਫ ਤੋਂ ਸਿਰਫ ਜੋ ਮਜ਼ਦੂਰ ਤਬਕੇ ਨਾਲ ਸੰਬੰਧਿਤ ਔਰਤਾਂ ਹਨ ਉਹ ਵੀ ਥੋੜ੍ਹੇ ਬਹੁਤ ਜਿਹਨਾਂ ਕੋਲ ਰੁਜ਼ਗਾਰ ਘੱਟ ਹੈ ਦੀ ਸਥਿਤੀ ਚੰਗੀ ਨਹੀਂ ਹੈ ਆਮ ਪਰ ਬਰਨਾਲੇ ਜ਼ਿਲ੍ਹੇ ਵਿੱਚ ਰੁਜ਼ਗਾਰ ਦੇ ਮੌਕੇ ਜ਼ਿਆਦਾ ਹਨ ਜਿਸ ਵਿੱਚ ਆਮ ਤੌਰ 'ਤੇ ਆਊਟਲੈਟ ਬਣਿਆ ਹੋਇਆ ਹੈ ਟਰਾਈਡੈਂਟ ਕੌਂਪਨੀ ਹੈ ਬਲਕਾਰ ਕੰਬਾਇਨ ਹੈ ਕਈ ਤਰ੍ਹਾਂ ਦੀਆਂ ਛੋਟੀਆਂ ਛੋਟੇ ਰੁਜ਼ਗਾਰ ਦੇ ਹੋਰ ਵੀ ਸਾਧਨ ਹਨ ਅਤੇ ਜਿਹਨਾਂ ਵਿੱਚੋਂ ਉਹ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕਦੀਆਂ ਹਨ ਬਰਨਾਲੇ ਜ਼ਿਲ੍ਹੇ ਵਿੱਚ ਢਿੱਲਵਾਂ ਵਿੱਚ ਪੜ੍ਹਾਈ ਸੰਬੰਧੀ ਯੂਨੀਵਰਸਿਟੀ ਕੈਂਪਸ ਖੁੱਲ੍ਹਿਆ ਹੋਇਆ ਬਰਨਾਲੇ ਜ਼ਿਲ੍ਹੇ ਵਿੱਚ ਬਰਨਾਲੇ ਸ਼ਹਿਰ ਵਿੱਚ ਯੂਨੀਵਰਸਿਟੀ ਕੈਂਪਸ ਹੈ